ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਉੱਥੇ ਕਰ ਰਹੇ ਓ ਤੁਸੀਂ ਹਾਂਜੀ ਠੀਕ ਹੈ

ਹਾਂਜੀ ਅੱਛਾ ਮਤਲਬ ਡੀਵੋਸ ਤੁਹਾਨੂੰ ਕਿਉਂ ਚਾਹੀਦਾ ਕੋਈ ਰੀਜਨ ਹਾਂਜੀ ਹਾਂਜੀ ਕਿੰਨਾਂ ਟਾਈਮ ਹੋ ਚੁੱਕਿਆ ਤੁਹਾਨੂੰ ਠੀਕ ਐ ਮਤਲਬ ਤੁਸੀਂ ਮਤਲਬ ਡੀਵੋਸ ਫਾਈਲ ਕੇਸ ਕਰਨਾ ਹੈ ਠੀਕ ਹੈ ਤੁਸੀਂ ਮਤਲਬ ਮੇਰੇ ਕੋਲ ਸਵੇਰ ਨੂੰ ਅੱਠ ਵਜੇ ਔਫ਼ਿਸ ਆ ਸਕਦੇ ਓ ਆ ਸਕਦੇ ਓ ਅਤੇ ਮੇਰਾ ਔਫ਼ਿਸ ਅੱਠ ਵਜੇ ਖੁੱਲ੍ਹ ਜਾਂਦਾ ਹੈ ਅਤੇ ਆਪਾਂ ਤੁਹਾਡਾ ਕੇਸ ਫਰਦਰ ਉੱਥੇ ਮਤਲਬ ਡਿਸਕਸ ਕਰਾਂਗੇ ਔਰ ਪ੍ਰੋਪਰ ਜੋ ਵੀ ਫੈਕਟ ਜਾਂ ਡੀਟੇਲਜ਼ ਹੈ ਉਹ ਤੁਸੀਂ ਮੈਨੂੰ ਉੱਥੇ ਪ੍ਰੋਵਾਇਡ ਕਰ ਦਿਓ ਫ਼ੀਸ ਸਟੱਕਚਰ ਤੁਹਾਡਾ ਮਤਲਬ ਚਾਲ਼ੀ ਪੰਜਾਹ ਹਜ਼ਾਰ ਤੱਕ ਤਾਂ ਲੱਗ ਹੀ ਜਾਵੇਗਾ ਬਾਕੀ ਦੇਖੋ ਮਤਲਬ ਕੇਸ 'ਤੇ ਡੀਪੈਂਡ ਕਰਦਾ ਹਾਂਜੀ ਹਾਂਜੀ ਮੈਂ ਤੁਹਾਨੂੰ ਫੌਰਵਰਡ ਕਰ ਦਵਾਂਗੀ ਹਾਂਜੀ ਜੋ ਕੋਰਟ ਫ਼ੀਸ ਵਗੈਰਾ ਉਹ ਤੁਸੀਂ ਮੇਰੇ ਔਫ਼ਿਸ ਦੀ ਸਾਰੀ ਡੀਟੇਲਜ਼ ਉੱਥੇ ਪ੍ਰੋਪਰਲੀ ਪ੍ਰੋਵਾਇਡ ਕਰ ਦਵਾਂਗੀ ਹਾਂਜੀ ਤੁਸੀਂ ਮਤਲਬ ਜੇ ਤੁਹਾਡੇ ਕੋਲ ਕੋਈ ਪਰੂਫ ਵਗੈਰਾ ਹੈ ਤੁਸੀਂ ਉਹ ਲੈ ਕੇ ਆ ਸਕਦੇ ਓ ਜੋ ਤੁਸੀਂ ਉਹਦੇ ਵਿੱਚ ਇੰਨਕਲੂਡ ਕਰਨਾ ਚਾਹੁੰਦੇ ਓ ਦੇ ਵਿੱਚ ਥੈਂਕ ਯੂ ਥੈਂਕ ਯੂ